ਹੈਲੋ ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਇੱਥੇ ਅੰਮ੍ਰਿਤਸਰ ਤੋਂ ਪਠਾਨਕੋਟ ਘੁੰਮਣ ਆਇਆ ਹੈਗਾ ਅਤੇ ਮੈਂ ਇੱਕ ਫੂਡ ਬਲੋਗਰ ਹੈਗਾ ਅਤੇ ਮੈਂ ਮੇਰਾ ਇੱਕ ਯੂਟੀਊਬ 'ਤੇ ਅਤੇ ਇੰਸਟਾਗ੍ਰਾਮ 'ਤੇ ਅਕਾਊਂਟ ਹੈਗਾ ਅਤੇ ਮੈਂ ਇੱਥੇ ਮੈਨੂੰ ਦੱਸਿਆ ਜਾਏ ਕੀ ਇੱਥੇ ਜਿਹੜਾ ਸਭ ਤੋਂ ਵੱਡੀ ਕੋਈ ਬੇਕਰੀ ਹੈਗੀ ਹੈ ਵਧੀਆ ਬੇਕਰੀ ਹੈਗੀ ਆ ਉਹ ਕਿਹੜੀ ਹੈਗੀ ਆ ਅੱਛਾ ਅੱਛਾ ਠੀਕ ਆ ਠੀਕ ਆ ਸਰ ਸ ਸਰ ਉੱਥੋਂ ਦਾ ਖਾਣ ਪੀਣ ਕਿੱਦਾਂ ਦਾ ਹੈਗਾ ਵਧੀਆ ਹੈਗਾ ਫਰੈਸ਼ ਹੈਗਾ ਜਾਂ ਇੱਦਾਂ ਹੀ ਹੈਗਾ ਅੱਛ ਅੱਛਾ ਠੀਕ ਹੈ ਠੀਕ ਹੈ ਸਰ ਟਾਈਮ ਦੱਸਿਓ ਸਰ ਕਿੰਨਾ ਹੈਗਾ ਵਾ ਕਿੰਨੇ ਤੋਂ ਕਿੰਨਾ ਠੀਕ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ